ਹਾਂ ਮੈਨੂੰ ਲੱਗਦਾ ਹੈ ਸਕੂਲਾਂ ਵਿੱਚ ਕਿੱਤਾ ਮੁਖੀ ਸਿੱਖਿਆਵਾਂ ਹੋਣੀਆਂ ਚਾਹੀਦੀਆਂ ਹਨ ਬੱਚਿਆਂ ਨੂੰ ਕਿੱਤਾ ਕਿੱਤੇ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ ਬੱਚਾ ਸ਼ੁਰੂ ਤੋਂ ਹੀ ਇਸੇ ਵੀ ਕਿ ਕਿੱਤੇ ਬਾਰੇ ਜਾਣਕਾਰੀ ਕਿਸੇ ਵੀ ਕਿੱਤੇ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਬੱਚਾ ਤਜ਼ਰਬੇਕਾਰ ਬਣ ਜਾਂਦਾ ਹੈ ਜਿਵੇਂ ਕਿ ਤਰਖਾਣ ਪਲੰਬਿੰਗ ਬਾਰੇ ਸਿਲਾਈ ਬਾਰੇ ਪਸ਼ੂ ਪਾਲਣ ਬਾਰੇ ਪੋਲਟਰੀ ਬਾਰੇ ਐਗਰੀਕਲਚਰ ਬਾਰੇ ਹੋਮ ਸਾਇੰਸ ਬਾਰੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹਨ ਬੱਚਾ ਕੋਈ ਵੀ ਆਪਣਾ ਮਨਮਸੰਦ ਸਬਜੈਕਟ ਜਿਵੇਂ ਚੁਣ ਸਕਦਾ ਹੈ ਬੱਚਾ ਉਸ ਵਿੱਚ ਤਜ਼ਰਬੇਕਾਰ ਹੋ ਜਾਂਦਾ ਹੈ ਕੱਲ੍ਹ ਨੂੰ ਬੱਚੇ ਨੂੰ ਅੱਗੇ ਕੋਈ ਆਪਣੀ ਜ ਜੀਵਨ ਵਿੱਚ ਕੋਈ ਬੱਚੇ ਨੂੰ ਪਰੇਸ਼ਾਨੀ ਨਹੀਂ ਆਉਂਦੀ ਉਸ ਦਾ ਝੁਕਾਅ ਜਿਸ ਵੱਲ ਹੋਏਗਾ ਜਿਹੜੇ ਜਿਸ ਚੀਜ਼ ਵੱਲ ਹੋਏਗਾ ਉਸ ਵੱਲ ਵੀ ਉਹ ਅੱਗੇ ਵਧੇਗਾ ਕੱਲ੍ਹ ਨੂੰ ਉਹਨੂੰ ਰੁਜ਼ਗਾਰ ਵਿੱਚ ਕੋਈ ਮੁਸ਼ਕਿਲ ਨਹੀਂ ਆਏਗੀ ਬੱਚੇ ਨੂੰ ਆਪਣਾ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਦਾ ਵਾ ਬੇਰੁਜ਼ਗਾਰੀ ਵੀ ਇਹਦੇ ਨਾਲ ਘੱਟ ਜਾਏਗੀ ਬਹੁਤ ਇਸ ਬੇਰੁਜ਼ਗਾਰੀ ਦਾ ਵੀ ਫਰਕ ਪਏਗਾ ਬੱਚੇ ਨੇ ਨਸ਼ਾ ਨਸ਼ੇ ਮੁਕਤ ਬੱਚਾ ਨਸ਼ੇ ਵੱਲ ਵੀ ਧਿਆਨ ਨਹੀਂ ਜਾਵੇਗਾ ਇਸ ਲਈ ਇਹੀ ਸਕੂਲ ਵਿੱਚ ਜ਼ਰੂਰ ਕੀ ਕਿੱਤਾ ਕੀ ਕਿੱਤੇ ਬਾਰੇ ਸਿੱਖਿਆ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਸਿੱਖਿਆ ਇਸ ਬਾਰੇ ਜ਼ਰੂਰ ਦੇਣੀ ਚਾਹੀਦੀ ਹੈ ਧੰਨਵਾਦ